ਪੰਦਰਾਂ ਜਨਵਰੀ ਦੋ ਹਜ਼ਾਰ ਅਠਾਰਾਂ ਸਤਾਈ ਜੂਨ ਦੋ ਹਜ਼ਾਰ ਅੱਠ ਤਿੰਨ ਮਈ ਉੱਨੀ ਸੌ ਬਾਨਵੇਂ ਗਿਆਰਾਂ ਸਤੰਬਰ ਦੋ ਹਜ਼ਾਰ ਵੀਹ ਤੀਹ ਜੁਲਾਈ ਉੱਨੀ ਸੌ ਅਠਾਨਵੇਂ